ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਵਧੀਆ ਤੁਸੀਂ ਸੁਣਾਓ ਕੀ ਕਰੀ ਜਾਂਦੇ ਹੋ ਅੱਛਾ ਅੱਛਾ ਬੱਚੇ ਠੀਕ ਆ ਠੰਡ ਤੋਂ ਬਚੇ ਆ ਹਾਂਜੀ ਜਿਹੜਾ ਆਪਣੇ ਬਾਹਰ ਚ ਟੋਆ ਆ ਉਹਦੇ ਬਾਰੇ ਗੱਲ ਕਰਦੇ ਹਾਂ ਹਾਂ ਮੀਂਹ ਨਾਲ ਆਪਣਾ ਔਖਾ ਤਾਂ ਹੋ ਜਾਂਦਾ ਹੈ ਨਾ ਚੱਲੋ ਕੋਈ ਨਹੀਂ ਫਿਰ ਆਪਾਂ ਹਾਂ ਆਪਾਂ ਨੂੰ ਕਾਫ਼ੀ ਜ਼ਿਆਦਾ ਦਿੱਕਤ ਆਉਂਦੀਆਂ ਇਹਨਾਂ 'ਚ ਦਿੱਕਤ ਤਾਂ ਹੁਣ ਦੇਖੋ ਤੁਹਾਨੂੰ ਵੀ ਆਉਂਦੀ ਦਿੱਕਤ ਸਾਨੂੰ ਵੀ ਆਉਂਦੀ ਆ ਲੰਘਣਾ ਤਾਂ ਸਾਰਿਆਂ ਨੇ ਹੁ ਹਾਂ ਅਤੇ ਕੋਈ ਨਹੀਂ ਫਿਰ ਆਪਾਂ ਕਰ ਲੈਂਦੇ ਹਾਂ ਫਿਰ ਇਹ ਕਿਹੜੀ ਗੱਲ ਆ ਹਾਂਜੀ ਹਾਂਜੀ ਕੋਈ ਨਹੀਂ ਕਰ ਲੈਂਦੇ ਹਾਂ ਹਾਂਜੀ ਹਾਂਜੀ ਹੋਰ ਜਦੋਂ ਵਹੀਕਲ ਵੁਹਕਲ ਟਪਾਉਂਦੇ ਸਿੱਧਾ ਟੋਏ 'ਚ ਵੱਜਦੇ ਆ ਫਿਰ ਔਖਾ ਹੋ ਜਾਂਦਾ ਗਾ ਨਾਲ ਰਾਤ ਬਰਾਤ ਆਪਾਂ ਨੇ ਲੰਘਣਾ ਹੁੰਦਾ ਤਾਂ ਬੰਦੇ ਨੂੰ ਪਤਾ ਨਹੀਂ ਲੱਗਦਾ ਨਾ ਹਾਂਜੀ ਹਾਂਜੀ ਹਾਂਜੀ ਕੋਈ ਨਹੀਂ ਫਿਰ ਆਪਾਂ ਗੱਲ ਕਰ ਲੈਂਦੇ ਹਾਂ ਆਪਾਂ ਆਪਾਂ ਆਪਣੀ ਗਲੀ ਦਾ ਧਿਆਨ ਰੱਖਾਂਗੇ ਆਪਾਂ ਭਰਾ ਭਰਵਾ ਲੈਦੇ ਹਾਂ ਫਿਰ ਆਪਾਂ ਟੋਏ ਟੂਏ ਜਿਹੜੇ ਟੋਏ ਹੈਗੇ ਆ ਪਾਣੀ ਪੂਣੀ ਭਰਦਾ ਅੱਗੇ ਸਿਆਲ ਆਉਂਦਾ ਫਿਰ ਹਾਂਜੀ ਮੈਂ ਕੋਈ ਨਾ ਇਹਨਾਂ ਨਾਲ ਹਸਬੈਂਡ ਨਾਲ ਗੱਲ ਕਰ ਲਾਂਗੀ ਘਰ ਫਿਰ ਆਪਾਂ ਮਿੱਟੀ ਲਿਆ ਕੇ ਫਿਰ ਮਿੱਟੀ ਪਵਾ ਕੇ ਸਾਰੇ ਟੋਏ ਭਰਦਾਂਗੇ ਹਾਂਜੀ ਹਾਂਜੀ ਅਗਲਾ ਕਹਿ ਦਿੰਦਾ ਨਹੀਂ ਨਹੀਂ ਕੰਮ ਤਾਂ ਰਲ ਕੇ ਕਰਨਾ ਚਾਹੀਦਾ ਗਲੀ ਟੋਏ ਤਾਂ ਸਾਰਿਆਂ ਦੇ ਦੇਖੋ ਤੁਸੀਂ ਵੀ ਲੰਘਣਾ ਮੈਡਮ ਅਸੀਂ ਵੀ ਲੰਘਣਾ ਹੈ ਨਾ ਗੱਲ ਨੰਘਣ ਦੀ ਹੁੰਦੀ ਹੈ ਤੁਸੀਂ ਵੀ ਲੰਘਣਾ ਅਸੀਂ ਵੀ ਲੰਘਣਾ ਦੋਨਾਂ ਧਿਰਾਂ 'ਚੋਂ ਕਿਸੇ ਨੂੰ ਪ੍ਰੋਬਲਮ ਨਾ ਆਵੇ ਹੈ ਨਾ ਕੋਈ ਨਹੀਂ ਆਪਾਂ ਕਰ ਲੈਂਦੇ ਹਾਂ

ਹਾਂ ਠੀਕ ਹੈ ਮੈਡਮ ਕਰ ਲਾਂਗੇ ਅਸੀਂ ਗੱਲ ਭਰਵਾ ਦਾਂਗੇ ਟੋਏ ਠੀਕ ਹੈ ਮੈਮ